ਵਿਆਹਾਂ ਵਰਗੇ ਵੱਡੇ ਸਮਾਰੋਹਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਅਸੀਂ ਟੈਂਕਰਾਂ ਦੀ ਵਰਤੋਂ ਕਰਦੇ ਹਨ ਅਸੀਂ ਵਿਆਹਾਂ ਵਿੱਚ ਪਾਣੀ ਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਲੋੜ ਅਨੁਸਾਰ ਅਸੀਂ ਟੈਂਕਰ ਮੰਗਵਾਉਂਦੇ ਹਨ ਉਸ ਟੈਂਕਰ ਵਾਲ਼ੇ ਪਾਣੀ ਨਾਲ਼ ਅਸੀਂ ਬਰਤਨ ਵੀ ਧੋ ਸਕਦੇ ਹਨ ਉਸ ਪਾਣੀ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਨ ਟੈਂਕਰ ਵਾਲਾ ਪਾਣੀ ਪੀਣ ਲਈ ਵੀ ਹੁੰਦਾ ਹੈ ਜਿਸ ਨੂੰ ਅਸੀਂ ਬੋਤਲਾਂ ਵਗੈਰਾ ਵਿੱਚ ਵੀ ਭਰ ਸਕਦੇ ਹਾਂ ਅਸੀਂ ਵਿਆਹਾਂ ਜਦੋਂ ਸਾਨੂੰ ਵਿਆਹਾਂ ਵਿੱਚ ਵੱਧ ਪਾਣੀ ਦੀ ਲੋੜ ਪੈਂਦੀ ਹੈ ਤਾਂ ਅਸੀਂ ਐਨ ਮੌਕੇ ਪਰ ਅਸੀਂ ਟੈਂਕਰ ਮੰਗਵਾ ਸਕਦੇ ਹਨ ਟੈਂਕਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਹੋ ਸਕਦੀ ਹੈ ਟੈਂਕਰ ਐਨ ਟਾਈਮ ਪਰ ਵੱਧ ਤੋਂ ਵੱਧ ਪਾਣੀ ਲ ਪਾਣੀ ਭਰ ਕੇ ਆ ਸਕਦਾ ਹੈ ਜਿਸ ਨਾਲ਼ ਸਾਡਾ ਬਹੁਤ ਸਾਰਾ ਕੰਮ ਜੋ ਸਰ ਜਾਂਦਾ ਹੈ